ਹੈਲੋ ਹਾਂਜੀ ਮਨਪ੍ਰੀਤ ਬੋਲਣ ਦੇ ਹਾਂਜੀ ਮੈਂ ਸੁਣਿਆ ਹੈ ਕਿ ਤੁਹਾਡੀ ਨਾ ਫਰੂਟਸ ਦੀ ਦੁਕਾਨ ਆ ਕਿਹੜੇ ਕਿਹੜੇ ਫਰੂਟਸ ਆ ਤੁਹਾਡੇ ਕੋਲ ਸਾਡੀ ਨਾ ਗੁਡੀਆ ਦਾ ਵਿਆਹ ਧਰਿਆ ਹੈ ਸਾਨੂੰ ਬਹੁਤ ਸਾਰਾ ਫਲ ਚਾਹੀਦਾ ਹੈ ਅਤੇ ਫਲ ਚੰਗੀ ਕੁਆਲਿਟੀ ਵਿਚ ਤਾਂ ਹੈਗਾ ਨਾ ਹਾਂਜੀ ਅੱਛਾ ਠੀਕ ਹੈ ਜੀ ਕੇਲੇ ਕਿਸ ਤਰ੍ਹਾਂ ਦਿੰਦੇ ਫਿਰ ਤੁਸੀਂ ਅੱਛਾ ਸੇਬ ਦਾ ਰੇਟ ਕੀ ਆ ਭਲਾ ਚਲੋ ਇੱਦਾਂ ਕਰੋ ਨਾ ਫਿਰ ਆ ਨਾ ਆਹ ਫਰੂਟ ਤੁਸੀਂ ਨਾ ਕਰ ਫਲ ਤੁਸੀਂ ਕਰ ਹੀ ਦਿਓ ਇਹ ਪੰਜ ਦਰਜਨਾਂ ਕੇਲੇ ਕਰ ਦਿਓ ਦੋ ਸੇਬ ਦੀਆਂ ਪੇਟੀਆਂ ਕਰ ਦਿਓ ਹਾਂਜੀ ਅਨਾਰ ਦੀਆਂ ਦੋ ਪੇਟੀਆਂ ਕਰ ਦਿਓ ਅਤੇ ਹੋਰ ਵੀ ਅੰਗੂਰ ਕਰ ਦਿਓ ਦੋ ਪੇਟੀਆਂ ਠੀਕ ਹੈ ਫਰੂਟ ਚੰਗ ਚੰਗਾ ਤਾਂ ਹੈ ਨਾ ਗਲ਼ਿਆ ਗਲ਼ਿਆ ਨਾ ਭੇਜ ਦਿਓ ਕਿਤੇ ਤੁਹਾਨੂੰ ਪਤਾ ਪ੍ਰੋਹਣਿਆਂ ਦੇ ਵਿੱਚ ਵੰਡਣਾ ਹੈ ਠੀਕ ਠੀਕ ਹੈ ਜੀ ਠੀਕ ਹੈ